ਸੋਸ਼ਲ ਮੀਡੀਆ ਪਲੇਟਫੋਮ ਜਿਵੇਂ ਕਿ ਫੇਸਬੁੱਕ ਟਵੀਟਰ ਅਤੇ ਇੰਸਟਾਗ੍ਰਾਮ ਅੱਜ ਦੇ ਸਮੇਂ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ ਇਹ ਪਲੇਟਫੋਮ ਲੋਕਾਂ ਨੂੰ ਦੁਨੀਆ ਭਰ ਦੇ ਵਿਅਕਤੀਆਂ ਨਾਲ ਜੋੜਨ ਦਾ ਮੌਕਾ ਦਿੰਦੇ ਹਨ ਮੈਂ ਅਕਸਰ ਫੇਸਬੁੱਕ 'ਤੇ ਆਪਣੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਦੀ ਹਾਂ ਇਹ ਮੰਜਰਾਂ ਅਤੇ ਯਾਦਾਂ ਨੂੰ ਸਾਂਝਾ ਕਰਨ ਦਾ ਇੱਕ ਸ਼ਾਨਦਾਰ ਜ਼ਰੀਆ ਹੈ ਇਸ ਟਰ ਇੰਸਟਾਗ੍ਰਾਮ ਅਤੇ ਫੇਸਬੁੱਕ 'ਤੇ ਮੈਨੂੰ ਬਹੁਤ ਹੀ ਪੁਰਾਣੇ ਪੁਰਾਣੇ ਮੇਰੇ ਦੋਸਤ ਮਿੱਤਰ ਮਿਲੇ ਹਨ ਜੋ ਕਿ ਦਸਵੀਂ ਤੋਂ ਬਾਅਦ ਮੇਰੇ ਨਾਲ ਵਿਛੜ ਗਏ ਸਨ ਮੈਂ ਤਸਵੀਰਾਂ ਵੀਡੀਓਜ਼ ਅਤੇ ਪੋਸਟਾਂ ਦੇ ਰਾਹੀਂ ਆਪਣੀ ਭਾਵਨਾਵਾਂ ਅਤੇ ਵਿਚਾਰਾਂ ਨੂੰ ਪ੍ਰਗਟ ਕਰਦੀ ਹਾਂ ਇੰਸਟਾਗ੍ਰਾਮ ਦੂਜੇ ਪਾਸੇ ਇੱਕ ਦ੍ਰਿਸ਼ਟੀ ਕੋਣ ਵਾਲਾ ਪਲੇਟਫੋਰਮ ਹੈ ਜਿੱਥੇ ਤਸਵੀਰਾਂ ਅਤੇ ਵੀਡੀਓਜ਼ ਦਾ ਮੂਲ ਰੂਪ ਵਿੱਚ ਪ੍ਰਦਰਸ਼ਨ ਹੁੰਦਾ ਹੈ ਮੈਂ ਅਕਸਰ ਇੱਥੇ ਪ੍ਰਕਿਰਤੀ ਦੀਆਂ ਤਸਵੀਰਾਂ ਯਾਤਰਾ ਦੇ ਪਲਾਂ ਅਤੇ ਆਪਣੇ ਰੋਜ਼ਾਨਾ ਜੀਵਨ ਦੀਆਂ ਛੋਟੀਆਂ ਵੱਡੀਆਂ ਗਤੀਵਿਧੀਆਂ ਸਾਂਝਾ ਕਰਦੀ ਹਾਂ ਇਹ ਪਲੇਟਫਾਰਮ ਮੈਨੂੰ ਵਿਦੇਸ਼ੀ ਸਥਾਨਾਂ ਅਤੇ ਸੱਭਿਆਚਾਰ ਬਾਰੇ ਜਾਣਕਾਰੀ ਦਿੰਦਾ ਹੈ ਜਿਸ ਨਾਲ ਮੇਰੀ ਸਿੱਖਣ ਦੀ ਖੁਦਰੁਸੀ ਵਾ ਵਾਜ ਵਧਦੀ ਹੈ ਟਵੀਟਰ ਆਪਣੇ ਤਰੀਕੇ ਨਾਲ ਇੱਕ ਸੂਚਿਤ ਪਲੇਟਫਾਰਮ ਹੈ ਮੈਂ ਇੱਥੇ ਅਜਿਹੀ ਸਮੱਗਰੀ ਪਸੰਦ ਕਰਦੀ ਹਾਂ ਜੋ ਤੁਰੰਤ ਜਾਣਕਾਰੀ ਦਿੰਦੀ ਹੈ ਜਿਵੇਂ ਕਿ ਨਿਊਜ਼ ਅਪਡੇਟਸ ਲੋਕਾਂ ਦੇ ਵਿਚਾਰ ਅਤੇ ਹੋਰ ਬਥੇਰੀਆਂ ਪੋਸਟਾਂ ਟਵੀਟਰ ਦੀ ਇੱਕ ਵਿਸ਼ੇਸ਼ਤਾ ਹੈ ਕਿ ਇਹ ਝੱਟ ਪੱਟ ਸਮੇਂ ਵਿੱਚ ਸਮੱਸਿਆਵਾਂ ਅਤੇ ਵਿਚਾਰ ਵਟਾਂਦਰੇ ਕਰਨ ਲਈ ਬਹੁਤ ਹੀ ਅਸਰਦਾਰ ਹੈ ਸੋਸ਼ਲ ਮੀਡੀਆ ਦਾ ਇੱਕ ਹੋਰ ਮਹੱਤਵਪੂਰਨ ਪਹਿਲੂ ਇਹ ਹੈ ਕਿ ਇਸ ਨਾਲ ਸਾਡੇ ਸਿੱਖਣ ਅਤੇ ਸਿਖਾਉਣ ਦੇ ਤਰੀਕੇ ਵਿੱਚ ਬਦਲਾਅ ਆ ਗਿਆ ਹੈ ਬਹੁਤ ਸਾਰੇ ਵਿਦਿਆਰਥੀ ਅਧਿਆਪਕ ਵੀਡੀਓ ਟਟੋਰੀਅਲ ਲੇਖਾਂ ਅਤੇ ਔਨਲਾਈਨ ਕੋਰਸਾਂ ਦੇ ਜ਼ਰੀਏ ਸਿੱਖਦੇ ਹਨ ਫਿਰ ਵੀ ਹਰ ਚੀਜ਼ ਦੀ ਤਰ੍ਹਾਂ ਸੋਸ਼ਲ ਮੀਡੀਆ ਦੇ ਵੀ ਕਈ ਨੁਕਸਾਨ ਹਨ ਕੁਛ ਲੋਕ ਇਹਨਾਂ ਦੇ ਬਹੁਤ ਹੀ ਜ਼ਿਆਦਾ ਗਲਤ ਵਰਤੋਂ ਕਰਦੇ ਹਨ ਕਈ ਵਾਰ ਇਸ ਇਹ ਸਮਾਂ ਬਰਬਾਦੀ ਦਾ ਕਾਰਨ ਬਣ ਜਾਂਦਾ ਹੈ ਇਸ ਦੇ ਅਤਿਰਿਕਤ ਕਈ ਵਾਰ ਝੂਠੀਆਂ ਜਾਣਕਾਰੀਆਂ ਅਤੇ ਫੇਕ ਨਿਊਜ਼ ਵੀ ਫੈਲਦੀਆਂ ਹਨ ਜਿਸ ਨਾਲ ਲੋਕਾਂ ਵਿੱਚ ਗਲਤ ਫਹਿਮੀਆਂ ਪੈਦਾ ਹੋ ਜਾਂਦੀਆਂ ਹਨ ਇਸ ਲਈ ਇਹ ਜ਼ਰੂਰੀ ਹੈ ਕਿ ਸੋਸ਼ਲ ਮੀਡੀਆ ਦੀ ਵਰਤੋਂ ਸਾਵਧਾਨੀ ਨਾਲ ਕੀਤੀ ਜਾਵੇ ਅਤੇ ਸੱਚੀ ਅਤੇ ਪੱਕੀ ਜਾਣਕਾਰੀ ਦੀ ਹੀ ਪਾਲਨਾ ਕੀਤੀ ਜਾਵੇ ਹਰ ਕਿਸੇ ਚੀਜ਼ ਦੀ ਵਰਤੋਂ ਕਰਨਾ ਆਪਣੇ ਹੱਥ ਵਿੱਚ ਹੁੰਦਾ ਹੈ ਕਿ ਆਪਾਂ ਉਸ ਦੀ ਵਰਤੋਂ ਚੰਗੇ ਮੱਥੇ ਲਈ ਕਰਨੀ ਹੈ ਜਾਂ ਗਲਤ ਮੱਥੇ ਲਈ ਕਰਨੀ ਹੈ ਇੰਸਟਾਗ੍ਰਾਮ ਅੱਜ ਕੱਲ੍ਹ ਜ਼ਿਆਦਾ ਹੀ ਫੇਮਸ ਹੋ ਚੁੱਕਿਆ ਹੈ ਫੇਸਬੁੱਕ ਨਾਲੋਂ ਇੰਸਟਾਗ੍ਰਾਮ 'ਤੇ ਅਸੀਂ ਫੋਟੋਜ਼ ਵੀਡੀਓਜ਼ ਕੁਛ ਵੀ ਅਪਲੋਡ ਕਰ ਸਕਦੇ ਹਾਂ ਇਸ ਦੇ ਨਾਲ ਸਾਨੂੰ ਬਹੁਤ ਜ਼ਿਆਦਾ ਜਾਣਕਾਰੀ ਮਿਲਦੀ ਹੈ ਕਿਉਂਕਿ ਲੋਕ ਇੱਥੇ ਬਹੁਤ ਸਾਰੀਆਂ ਰੀਲਾਂ ਬਣਾ ਬਣਾ ਪਾਉਂਦੇ ਹਨ ਆਪਾਂ ਨੂੰ ਜਿਸ ਚੀਜ਼ ਦੀ ਨੋਲੇਜ ਨਹੀਂ ਹੁੰਦੀ ਉਹ ਵੀ ਆਪਾਂ ਨੂੰ ਇੱਥੋਂ ਮਿਲਦੀ ਹੈ ਬਾਕੀ ਹਰ ਇੱਕ ਚੀਜ਼ ਦੀ ਵਰਤੋਂ ਕਰਨਾ ਆਪਣੇ ਹੱਥ ਵਿੱਚ ਹੁੰਦਾ ਹੈ ਕਿ ਆਪਾਂ ਉਸ ਦੀ ਵਰਤੋਂ ਕਿਸ ਤਰ੍ਹਾਂ ਕਰਨੀ ਹੈ ਅਤੇ ਕਿਸ ਤਰ੍ਹਾਂ ਨਹੀਂ ਕਰਨੀ ਅੱਜ ਕੱਲ੍ਹ ਹਰ ਇੱਕ ਦੇ ਕੋਲ ਮੋਬਾਈਲ ਤਾਂ ਹੁੰਦੇ ਹੀ ਹੈ ਅਤੇ ਸੋਸ਼ਲ ਲਾਈਫ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਕਿ ਲੋਕਾਂ ਨੂੰ ਅਖ਼ਬਾਰ ਦੀ ਵੀ ਲੋੜ ਨਹੀਂ ਪੈਂਦੀ ਹਰ ਇੱਕ ਨਿਊਜ਼ ਇੱਥੇ ਹੀ ਮਿਲ ਜਾਂਦੀ ਹੈ